ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੱਸੋ ਹਾਂ ਵਧੀਆ ਅੱਜ ਕੱਲ੍ਹ ਤਾਂ ਭੈਣਾਂ ਬੇਰੁਜ਼ਗਾਰੀ ਬਹੁਤ ਹੈ ਬੱਚੇ ਵੇਹਲੇ ਫਿਰਦੇ ਪਏ ਹੈ ਹੋਰ ਕੀ ਕਰਨਾ ਆ ਵੇਹਲੇ ਹੀ ਆ ਅਸੀਂ ਵੀ ਹਾਂਜੀ ਇੱਦਾਂ ਹੈ ਕਿ ਨਿਆਣੇ ਵਿਚਾਰੇ ਇੰਨੀਆਂ ਡਿਗਰੀਆਂ ਕਰ ਕਰਕੇ ਅਤੇ ਹੁਣ ਬਾਹਰ ਨੂੰ ਭੇਜਦੇ ਆ ਵਿਹਲੇ ਰਹਿੰਦੇ ਆ ਸਾਹਮਣੇ ਚੰਗੇ ਵੀ ਨਹੀਂ ਲੱਗਦੇ ਹੁਣ ਕੀ ਕਰੀਏ ਬੱਚਿਆਂ ਨੂੰ ਕੀ ਕਹਿ ਸਕਦੇ ਹਾਂ ਅਸੀਂ ਇੰਨਾਂ ਇੰਨਾਂ ਪੈਸਾ ਖਰਚ ਕੇ ਵੀ ਬੱਚੇ ਘਰ ਬੈਠੇ ਆ ਅਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਜੋ ਵੀ ਬੇਰੁਜ਼ਗਾਰ ਬੱਚੇ ਇਹਨਾਂ ਨੂੰ ਜ਼ਰੂਰੀ ਰੁਜ਼ਗਾਰ ਦੇਣਾ ਚਾਹੀਦਾ ਹੈ ਉਹ ਵੀ ਰੁਜ਼ਗਾਰ ਦੇ ਬਿਨਾਂ ਹੀ ਬੱਚੇ ਤੇ ਤਾਂ ਹੀ ਬੱਚੇ ਅਨਪਲਾਈ ਹੈ ਤਾ ਤਾਂ ਹੀ ਨਸ਼ਿਆਂ ਦੇ ਵੱਲ ਨੂੰ ਚੱਲਦੇ ਹੈ ਕੀ ਕਰਨਾ ਬੱਚਿਆਂ ਨੂੰ ਤਾਂ ਚਾਹੀਦਾ ਨਾ ਸਰਕਾਰ ਨੂੰ ਵੀ ਇਨਪਲੋਈ ਨੂੰ ਜ਼ਰੂਰੀ ਜੋ ਪੜ੍ਹਿਆ ਲਿਖਿਆ ਉਹਨੂੰ ਤਾਂ ਦੇਣੀ ਦੇਣੀ ਚਾਹੀਦੀ ਹੈ ਨੌਕਰੀ ਹਾਂਜੀ ਹੋਰ ਸੁਣਾਓ ਤੁਸੀਂ ਸੁਣਾਓ ਹਾਂ ਤਾਂ ਕੀ ਕਰਨਾ ਇੰਨਾਂ ਪੜ੍ਹ ਲਿਖ ਕੇ ਵੀ ਘਰ ਹੀ ਬਹਿਣਾ ਜਦ ਤੱਕ ਨਹੀਂ ਸਰਕਾਰ ਜੋਬ ਦੇਵੇ ਹਾਂ ਕ਼ੁਆਸ਼ਨ ਹੀ ਇੰਨੇ ਇੰਨੇ ਔਖੇ ਪਾ ਦਿੰਦੇ ਜਾਣ ਕੇ ਹੀ ਔਖੇ ਪਾਉਂਦੇ ਟੈਸਟ ਵੀ ਜਾਂ ਬੱਚਾ ਕਲੀਅਰ ਕਰ ਨਾ ਪਏ ਅਗਰ ਕਲੀਅਰ ਕਰ ਪਾਏਗਾ ਤਾਂ ਇਹਨਾਂ ਨੂੰ ਤਾਂ ਨੌਕਰੀ ਦੇਣੀ ਪੈਣੀ ਹੈ ਸਰਕਾਰ ਵੀ ਬਥੇਰੀ ਚਲਾਕ ਹੈ ਸਰਕਾਰ ਦੀ ਕਿਹੜੀ ਗੱਲ ਹੈ ਹਾਂਜੀ ਹਾਂਜੀ ਨਹੀਂ ਜੋਬ ਤਾਂ ਕਰਦੇ ਆ ਸਾਡੇ ਤਾਂ ਚਲੋ ਮਾੜੇ ਮੋਟੇ ਸਟੈਂਡ ਅਜੇ ਕੀਤੇ ਹੀ ਹੈ ਹੁਣ ਇਹ ਗੁਆਂਢੀਆਂ ਦਾ ਬੱਚਾ ਦੇਖ ਲਓ ਵਿਚਾਰੇ ਨੇ ਇੰਨੀਆਂ ਡਿਗਰੀਆਂ ਕੀਤੀਆਂ ਇੰਨੀ ਉਹਨੇ ਦੌੜਾਂ ਭੱਜਾਂ ਲਾਈਆਂ ਅਤੇ ਫਿਰ ਵੀ ਨਹੀਂ ਅਤੇ ਕਿੰਨਾ ਪੈਸਾ ਧੇਲਾ ਖਰਚਿਆ ਤਾਂ ਵੀ ਨਹੀਂ ਉਹਦੇ ਵਿਚਾਰੇ ਦੀ ਗੱਲ ਬਣੀ ਅਤੇ ਇੱਦਾਂ ਹੀ ਹੈ ਇੱਕ ਦੂਜੇ ਵੱਲ ਵੇਖ ਕੇ ਫਿਰ ਹੁੰਦਾ ਹੀ ਹੈ ਮਨ ਦੇ ਵਿੱਚ ਇੰਨੀ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਵੀ ਤਾਂ ਮਿਲਣਾ ਚਾਹੀਦਾ ਨਾ ਇਹਦੇ 'ਚ ਮਿਹਨਤ ਵਿਚਾਰਿਆਂ ਨੇ ਫਲ ਫਿਰ ਕੀ ਫਾਇਦਾ ਬੱਚਿਆਂ ਦਾ ਫਿਰ ਦਿਲ ਟੁੱਟ ਜਾਂਦਾ ਭੈਣ ਜੀ ਮੁੜ ਕੇ ਨੌਕਰੀ ਨਹੀਂ ਜੇ ਮਿਲਦੀ ਹਾਂ